ਇੱਕ ਮਈ ਉੱਨੀ ਸੌ ਚੁਰਾਸੀ ਦੋ ਜੂਨ ਦੋ ਹਜ਼ਾਰ ਚਾਰ ਜੁਲਾਈ ਦੋ ਹਜ਼ਾਰ ਦਸ ਪੰਜ ਅਗਸਤ ਦੋ ਹਜ਼ਾਰ ਤੇਈ ਅਠਾਰਾਂ ਅਕਤੂਬਰ ਦੋ ਹਜ਼ਾਰ ਇੱਕ